ਪੰਜਾਬ ਵਿੱਚ ਹੋਰ ਜ਼ਿਲ੍ਹਿਆਂ ਬਾਰੇ ਤਾਂ ਮੈਨੂੰ ਪਤਾ ਨਹੀਂ ਪਰ ਅਸੀਂ ਪਟਿਆਲਾ ਸ਼ਹਿਰ ਵਿੱਚ ਰਹਿੰਦੇ ਹਾਂ ਪਟਿਆਲਾ ਸ਼ਹਿਰਾਂ ਵਿੱਚ ਸਾਨੂੰ ਪਤਾ ਕਿ ਜਿਹੜਾ ਬਾਜ਼ਾਰ ਆ ਸ਼ੇਰ ਏ ਪੰਜਾਬ ਮਾਰਕੀਟ ਆ ਹੋਰ ਆਪਣੇ ਪਟਿਆਲੇ ਵਿੱਚ ਬਹੁਤ ਵਧੀਆ ਬਾਜ਼ਾਰ ਨੇ ਜਿੱਥੇ ਕਿ ਸੈਲਾਨੀ ਦੇਖਣਾ ਪਸੰਦ ਕਰਦੇ ਹਨ ਇੱਥੇ ਆਪਣਾ ਅੰਦਰ ਕਿਲ੍ਹੇ ਬਣਿਆ ਹੋਇਆ ਕਿਲ੍ਹਾ ਬਣਿਆ ਹੋਇਆ ਜਿੱਥੇ ਬਹੁਤ ਹੀ ਪੁਰਾਣੀਆਂ ਚੀਜ਼ਾਂ ਸ਼ਾਸਤਰ ਪਏ ਨੇ ਹੋਰ ਤੋਪਾਂ ਪਈਆਂ ਹੈ ਉਹ ਦੇਖਣ ਆਉਂਦੇ ਆ ਸੈਲਾਨ ਅਤੇ ਆਪਣੇ ਇੱਥੇ ਆਪਣੇ ਕੁੜਤੇ ਪਜਾਮੇ ਪਟਿਆਲੇ ਦੇ ਬਹੁਤ ਮਸ਼ਹੂਰ ਨੇ ਅਤੇ ਆਪਣੇ ਸਲਵਾਰ ਸੂਟ ਜਿਹੜੇ ਸੈਲਾਨੀ ਆਉਂਦੇ ਆ ਦੂਰੋਂ ਦੂਰੋਂ ਅਤੇ ਆਪਣਾ ਇਹ ਚੀਜ਼ਾਂ ਲੈਣੀਆਂ ਪਸੰਦ ਕਰਦੇ ਹਨ ਕਿਉਂਕਿ ਉਹ ਜਿਹੜੇ ਬਾਹਰਲੇ ਸੈਲਾਨੀ ਨੇ ਉਹਨਾਂ ਨੂੰ ਆਪਣੇ ਪੰਜਾਬ ਦੇ ਕਲਚਰ ਨੂੰ ਦੇਖ ਕੇ ਬੜੀ ਖੁਸ਼ ਹੁੰਦੀ ਹੈ ਕਿ ਇਹ ਚੀਜ਼ਾਂ ਭੀੜੇ ਬਾਜ਼ਾਰ ਨੇ ਪੁਰਾਣੇ ਬਾਜ਼ਾਰ ਨੇ ਚੀਜ਼ਾਂ ਬਹੁਤ ਹੀ ਵਧੀਆ ਅਤੇ ਸਸਤੀਆਂ ਨੇ ਇਸ ਲਈ ਸੈਲਾਨੀਆਂ ਨੂੰ ਵੱਧ ਤੋਂ ਵੱਧ ਆਕਰਸ਼ਕ ਕਰਦੀਆਂ ਨੇ ਖ਼ਾਸ ਕਰ ਪ ਪਟਿਆਲੇ ਵਿੱਚ ਬਾਕੀ ਹਾਂ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਥਾਵਾਂ ਨੇ ਪਰ ਉਹਦੇ ਬਾਰੇ ਆਪਾਂ ਨੂੰ ਪਤਾ ਨਹੀਂ ਕਿਉਂਕਿ ਅਸੀਂ ਪਟਿਆਲੇ ਰਹਿੰਦੇ ਹਾਂ ਇਸ ਲਈ ਪਟਿਆਲੇ ਬਾਰੇ ਅਸੀਂ ਦੱਸ ਰਹੇ ਹਾਂ